ਸਤਿ ਸ਼੍ਰੀ ਅਕਾਲ ਜੀ ਮੈਂ ਦਵਿੰਦਰ ਕੌਰ ਗੱਲ ਕਰ ਰਹੀ ਹਾਂ ਮੈਂ ਤੁਹਾਡੀ ਵੈੱਬਸਾਈਟ ਤੋਂ ਇੱਕ ਫੇਸ ਮਾਸਕ ਅਤੇ ਸਕ੍ਰੱਬ ਮੰਗਵਾਇਆ ਸੀ ਜਿਸ ਦੀ ਡਿਲੀਵਰੀ ਇੱਕ ਮਹੀਨੇ ਬਾਅਦ ਹੋ ਰਹੀ ਹੈ ਜਦੋਂ ਕਿ ਤੁਸੀਂ ਮੈਨੂੰ ਦੱਸਿਆ ਸੀ ਕਿ ਇਸਦੀ ਜੋ ਡਿਲੀਵਰੀ ਹੈ ਉਹ ਦਸ ਦਿਨਾਂ ਦੇ ਅੰਦਰ ਅੰਦਰ ਹੋਵੇਗੀ ਦੂਜਾ ਇਸਦੀ ਪੈਕਿੰਗ ਬਹੁਤ ਹੀ ਜ਼ਿਆਦਾ ਬੇਕਾਰ ਤਰੀਕੇ ਨਾਲ ਕੀਤੀ ਹੋਈ ਸੀ ਤੁਸੀਂ ਮੈਨੂੰ ਉਸ ਵਿੱਚ ਦਿਖਾਇਆ ਸੀ ਕਿ ਮੈਨੂੰ ਦੋ ਸਕ੍ਰੱਬ ਅਤੇ ਫੇਸ ਮਾਸਕ ਦੀਆਂ ਪੰਜ ਸ਼ੀਟਸ ਮਿਲਣਗੀਆਂ ਜਦਕਿ ਪਾਰਸਲ ਪਹੁੰਚਣ ਉੱਤੇ ਮੈਂ ਦੇਖਿਆ ਕਿ ਮੈਨੂੰ ਇੱਕ ਸਕ੍ਰੱਬ ਅਤੇ ਤਿੰਨ ਸ਼ੀਟਸ ਮਿਲੀਆਂ ਹਨ ਇਸਦੀ ਜੋ ਐਕਸਪਾਇਰੀ ਡੇਟ ਹੈ ਉਹ ਵੀ ਬਹੁਤ ਹੀ ਜ਼ਿਆਦਾ ਨੇੜੇ ਸੀ ਜਦੋਂ ਮੈਂ ਇਸ ਨੂੰ ਆਪਣੇ ਹੱਥ ਉੱਤੇ ਲਗਾਇਆ ਤਾਂ ਮੇਰੇ ਹੱਥ ਉੱਤੇ ਰੈਸ਼ਿਜ ਹੋ ਗਏ ਰੈਡਨੈਸ ਹੋ ਗਈ ਤੇ ਮੈਨੂੰ ਬਹੁਤ ਹੀ ਜਿਆਦਾ ਇਚਿੰਗ ਹੋ ਰਹੀ ਸੀ ਜਿਸ ਕਾਰਨ ਮੈਨੂੰ ਡੋਕਟਰ ਕੋਲ਼ ਜਾਣਾ ਪਿਆ ਅਤੇ ਮੈਨੂੰ ਦਵਾਈ ਲੈਣੀ ਪਈ ਇਸ ਨਾਲ਼ ਮੇਰੀ ਸਕਿਨ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਮੇਰੀ ਪੇਮੈਂਟ ਮੈਨੂੰ ਵਾਪਸ ਕਰ ਦਿਉ ਇਹ ਬਹੁਤ ਹੀ ਜ਼ਿਆਦਾ ਮਹਿੰਗਾ ਪ੍ਰੋਡਕਟ ਸੀ ਮਹਿੰਗਾ ਹੋਣ ਦੇ ਬਾਵਜੂਦ ਵੀ ਇਸਨੇ ਮੈਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ ਮੈਂ ਆਪਣੇ ਦੋਸਤਾਂ ਨੂੰ ਇਹ ਦੱਸਾਂਗੀ ਕਿ ਉਹ ਤੁਹਾਡੇ ਤੋਂ ਕਦੇ ਵੀ ਕੋਈ ਵੀ ਸ਼ੋਪਿੰਗ ਨਾ ਕਰਨ ਅਤੇ ਮੈਂ ਬਾ ਲਾਸਟ ਵਿੱਚ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਮੇਰੀ ਪੇਮੈਂਟ ਵਾਪਸ ਕਰੋ